ਪੰਜਾਬ ਵਿੱਚ ਮੁੱਖ ਬੈਂਕਿੰਗ ਅਤੇ ਬੀਮਾ ਰੁਝਾਨ ਅਤੇ ਵਿਕਾਸ ਇਹ ਹਨ ਜੋ ਆਪਾਂ ਬਹੁਤ ਚੀਜ਼ਾਂ ਵੱਲ ਧਿਆਨ ਦੇਣ ਯੋਗ ਹਨ ਜਿਵੇਂ ਖੇਤੀ ਅਤੇ ਬੈਂਕਿੰਗ ਪੰਜਾਬ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀ 'ਤੇ ਆਧਾਰਿਤ ਹੈ ਇਸ ਕਰਕੇ ਕ੍ਰਿਸ਼ੀ ਬੈਂਕਿੰਗ ਜਿਵੇਂ ਐਗਰੀਕਲਚਰ ਬੈਂਕਿੰਗ ਮਹੱਤਵਪੂਰਨ ਰੁਝਾਨ ਹੈ ਸਹਿਕਾਰੀ ਬੈਂਕਿੰਗ ਜਿਵੇਂ ਕੋਪਰੇਟਿਵ ਬੈਂਕਸ ਅਤੇ ਰਾਜ ਦੇ ਬੈਂਕ ਜਿਵੇਂ ਪੰਜਾਬ ਨੈਸ਼ਨਲ ਬੈਂਕ ਖੇਤੀਬਾੜੀ ਲਈ ਰਿਣ ਲੋਨ ਅਤੇ ਸੁਵਿਧਾਵਾਂ ਦਿੰਦੇ ਹਨ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਯੋਜਨਾਵਾਂ ਦੇ ਕਾਰਨ ਖੇਤੀਬਾੜੀ ਰਿਣਾਂ ਦੀ ਮੰਗ ਵੱਧ ਰਹੀ ਹੈ ਡਿਜੀਟਲ ਬੈਕਿੰਗ ਅਤੇ ਯੂ ਪੀ ਆਈ ਵਿਰੋਧ ਵਧੋਰੀ ਪੰਜਾਬ ਅਤੇ ਸਿੰਡ ਬੈਂਕ ਵਰਗੇ ਬੈਂਕ ਡਿਜੀਟਲ ਬੈਂਕਿੰਗ ਅਤੇ ਯੂ ਪੀ ਆਈ ਨੂੰ ਪ੍ਰਮੋਟ ਕਰ ਰਹੇ ਹਨ ਜਿਵੇਂ ਫੋਨਪੇ ਗੂਗਲ ਪੇ ਪੇਟੀਐਮ ਵਰਗੇ ਪਲੈਟਫਾਰਮ ਰੂਰਲ ਖੇਤਰਾਂ ਵਿੱਚ ਵੀ ਲੋਕ ਪਰੀਜ ਹੋ ਰਹੇ ਹਨ ਇੰਟਰਨੈਟ ਬੈਂਕਿੰਗ ਮੋਬਾਈਲ ਬੈਂਕਿੰਗ ਅਤੇ ਨੀਓ ਬੈਂਕਿੰਗ ਦੀ ਮੰਗ ਵੱਧ ਰਹੀ ਹੈ ਬੀਮਾ ਦਾ ਵਾਧੂ ਰੁਝਾਨ ਖੇਤੀਬਾੜੀ ਬੀਮਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੰਜਾਬ ਵਿੱਚ ਵੱਧ ਰਹੀ ਹੈ ਟਰਮੀਨਲ ਅਤੇ ਜੀਵਨ ਬੀਮਾ ਦੀ ਲੋੜ ਵੱਧ ਰਹੀ ਹੈ ਖਾਸ ਕਰਕੇ ਐਨ ਆਰ ਆਈ ਅਤੇ ਐਨ ਆਰ ਪੰਜਾਬੀਆਂ ਵਿੱਚ